ਹੈਲੋ ਸਤਿ ਸ਼੍ਰੀ ਅਕਾਲ ਸਰ ਕਿਵੇਂ ਹੋ ਜੀ ਸਰ ਮੈਂ ਤੁਹਾਡੇ ਰਾਤੀ ਨਾ ਤੁਹਾਡੇ ਏਜੰਸੀ ਥਰੂ ਆਪਣੇ ਘਰ ਤੱਕ ਪਹੁੰਚਿਆ ਜਿਸ ਲਈ ਮੈਂ ਤੁਹਾਡਾ ਕਹਿ ਲਉ ਬਹੁਤ ਸ਼ੁਕਰਗੁਜ਼ਾਰ ਹਾਂ ਜਿਵੇਂ ਮੈਂ ਰਾਤੀ ਅੰਮ੍ਰਿਤਸਰ ਆਇਆ ਏਅਰਪੋਰਟ ਤੋਂ ਅਤੇ ਉਹ ਤੋਂ ਬਾਅਦ ਮੈਂ ਜਲੰਧਰ ਆਉਣਾ ਸੀਗਾ ਬਟ ਉਸ ਵੇਲੇ ਆਉਣ ਜਾਣ ਨੂੰ ਕੋਈ ਤੁਹਾਨੂੰ ਪਤਾ ਵੀ ਦੂਜੇ ਦੀ ਰਿਸੋਰਸ ਨਹੀਂ ਸੀ ਕੋਈ ਸਾਧਨ ਨਹੀਂ ਸੀ ਬੱਸ ਦਾ ਟਾਈਮ ਨਹੀਂ ਸੀਗਾ ਅਤੇ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਤੁਹਾਡੇ ਲਾਗੇ ਆਫਿਸ ਹੈ ਅਤੇ ਉੱਥੋਂ ਜਾ ਕੇ ਕਨਫਰਮ ਥੋੜ੍ਹਾ ਕਰ ਲਉ ਅਤੇ ਮੈਨੂੰ ਤੁਹਾਡੇ ਏਜੰਸੀ ਦੇ ਵਿੱਚੋਂ ਇੱਕ ਬੰਦਾ ਮਿਲਿਆ ਜੀ ਅਤੇ ਉਹ ਬਹੁਤ ਹੀ ਵਧੀਆ ਬੀਬਾ ਬੰਦਾ ਸੀ ਜਿਹਨੇ ਮੈਨੂੰ ਰਾਤੀ ਦੇਰ ਮਤਲਬ ਕਾਫੀ ਲੇਟ ਹੋ ਚੁੱਕਾ ਸੀ ਘਰੇ ਬਹੁਤ ਸਹੀ ਤਰੀਕੇ ਨਾਲ ਲੈ ਕੇ ਆਇਆ ਅਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਉਹਦ ਉਸ ਬੰਦੇ ਦਾ ਬੜਾ ਧੰਨਵਾਦੀ ਹਾਂ ਮੈਂ ਕਿਉਂਕਿ ਰਾਤ ਦਾ ਸਫਰ ਤੁਹਾਨੂੰ ਪਤਾ ਬਹੁਤ ਡੇਂਜਰਸ ਹੋ ਸਕਦਾ ਸੀਗਾ ਬਟ ਨਹੀਂ ਹੀ ਇਜ ਵੈਰੀ ਗੁੱਡ ਬੋਏ ਸੋ ਜਿਹੜਾ ਸਾਡਾ ਰਾਜਨ ਸੀ ਤੁਹਾਡਾ ਉਹਦੇ ਲਈ ਮੇਰੇ ਵੱਲੋਂ ਥੈਂਕਸ ਜ਼ਰੂਰ ਕਹਿ ਦਿਓ ਅਤੇ ਸਰ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਵਾਂਗਾ ਜੇ ਅਗਲੀ ਵਾਰ ਤੋਂ ਮੈਨੂੰ ਇੱਦਾਂ ਹੀ ਕਿਤੇ ਆਉਣਾ ਜਾਣਾ ਹੋਵੇ ਤਾਂ ਮੈਨੂੰ ਪਲੀਜ਼ ਉਹੀ ਬੰਦਾ ਹੀ ਪ੍ਰੋਵਾਈਡ ਕਰਿਓ ਅਤੇ ਉਹ ਬਹੁਤ ਵਧੀਆ ਬੰਦਾ ਸੀ ਅਤੇ ਮੈਂ ਤੁਹਾਡੇ ਏਜੰਸੀ ਦਾ ਬਹੁਤ ਧੰਨਵਾਦੀ ਹਾਂ